ਦਸ ਤੋਂ ਦਸ ਲੱਖ ਦੇ ਵਿੱਚ ਪੰਜ ਨੰਬਰ ਹੁੰਦੇ ਹੈ ਨੱਬੇ ਹਜ਼ਾਰ ਅੱਸੀ ਹਜ਼ਾਰ ਪਚਾਸੀ ਹਜ਼ਾਰ ਸੱਤਰ ਹਜ਼ਾਰ ਪਝੱਤਰ ਚੌਂਹਠ ਹਜ਼ਾਰ